ਦੋ ਲੱਖ ਪੰਤਾਲੀ ਹਜ਼ਾਰ ਇੱਕ ਸੌ ਨੱਬੇ ਪੰਜ ਲੱਖ ਛਿਆਨਵੇਂ ਹਜ਼ਾਰ ਇੱਕ ਸੌ ਗਿਆਰਾਂ ਅੱਠ ਲੱਖ ਨੱਬੇ ਹਜ਼ਾਰ ਛੇ ਸੌ ਨੱਬੇ ਨੌ ਲੱਖ ਨੜਿਨਵੇਂ ਹਜ਼ਾਰ ਲੱਖ ਸੱਤ ਲੱਖ ਦਸ ਹਜ਼ਾਰ ਇੱਕ ਸੌ ਦਸ